ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਬਚਪਨ ਵਿੱਚ ਸਕੂਲ ਜਾਂਦਾ ਸੀ ਤਾਂ ਸਕੂਲ ਬੈਗ ਜਦੋਂ ਮੇਰੇ ਮੋਢਿਆਂ 'ਤੇ ਹੁੰਦਾ ਸੀ ਤਾਂ ਮੈਨੂੰ ਐਵੇਂ ਹੇ ਲੱਗਦਾ ਸੀ ਵੀ ਪਤਾ ਨਹੀਂ ਮੈਂ ਕਿੰਨਾ ਕੀ ਵਜਨ ਚੁੱਕਿਆ ਹੋਇਆ ਹੈ ਇਸ ਕਰਕੇ ਸਕੂਲ ਬੈਗ ਮੇਰੇ ਹਿਸਾਬ ਨਾਲ ਸਕੂਲ ਬੈਗ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਉਹਦੇ ਵਿੱਚ ਘੱਟ ਤੋਂ ਘੱਟ ਕਿਤਾਬਾਂ ਪਾਉਣੀਆਂ ਚਾਹੀਦੀਆਂ ਹਨ ਵੈਸੇ ਤਾਂ ਸਕੂਲ ਬੈਗ ਦੀ ਵਰਤੋਂ ਹੀ ਨਹੀਂ ਕਰਨੀ ਚਾਹੀਦੀ ਬੱਚਿਆਂ ਨੂੰ ਖਾਸ ਕਰਕੇ ਕਿਉਂਕਿ ਸਕੂਲ ਬੈਗ ਦੇ ਕੁਝ ਹਾਨੀਕਾਰਕ ਚੀਜ਼ਾਂ ਇਹ ਨੇ ਵੀ ਸਕੂਲ ਬੈਗ ਬੱਚਿਆਂ ਦੀ ਗਰੋਥ ਨੂੰ ਰੋਕਦਾ ਹੈ ਕਿਉਂਕਿ ਵਜਨ ਉਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਵੀਹ ਪੱਚੀ ਕਿੱਲੋ ਵਜਨ ਤਾਂ ਹੁੰਦਾ ਹੀ ਹੈ ਕਿਤਾਬਾਂ ਦਾ ਤਾਂ ਉਹਦੇ ਵਿੱਚ ਵਜਨ ਦੇ ਨਾਲ ਬੱਚਿਆਂ ਦੀ ਗਰੋਥ 'ਤੇ ਬਹੁਤ ਹੀ ਜ਼ਿਆਦਾ ਡੂੰਘਾ ਅਸਰ ਪੈਂਦਾ ਹੈ ਜਿਸ ਕਰਕੇ ਬੱਚਿਆਂ ਦੀ ਗਰੋਥ ਰੁੱਕਦੀ ਹੈ ਅਤੇ ਬੱਚਿਆਂ ਦਾ ਰੀਡ ਦੀ ਹੱਡੀ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਸਕੂਲ ਬੈਗ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ